ਹਾਂਜੀ ਜਿਸ ਤਰ੍ਹਾਂ ਅਸੀਂ ਹੁਣ ਘਰ ਵਿੱਚ ਪੀਣ ਵਾਸਤੇ ਚਾਹ ਵੀ ਬਣਾਉਂਦੇ ਹਾਂ ਚਾਹ ਨੂੰ ਪਾਣੀ ਉਬਾਲਣਾ ਧਰਕੇ ਪਾਣੀ ਗਰਮ ਹੋਣ 'ਤੇ ਅਸੀਂ ਇਹਦੇ ਵਿੱਚ ਮਸਾਲਾ ਪਾਉਂਂਦੇ ਹਾਂ ਪੱਤੀ ਪਾ ਕੇ ਖੰਡ ਪਾ ਕੇ ਉਹਨੂੰ ਥੋੜ੍ਹਾ ਰਿੰਨ੍ਹਦੇ ਹਾਂ ਬਾਅਦ 'ਚ ਰਿੰਨ੍ਹਣ ਤੋਂ ਬਾਅਦ ਦੁੱਧ ਪਾ ਕੇ ਫਿਰ ਉਬਾਲਾ ਆਉਣ 'ਤੇ ਸਾਡੀ ਚਾਹ ਬਣ ਜਾਂਦੀ ਆ ਜਿਸ ਤਰ੍ਹਾਂ ਹੁਣ ਕਈ ਲੋਕ ਚਾਹ ਨਹੀਂ ਪੀਂਦੇ ਉਹ ਦੁੱਧ ਪੀਂਦੇ ਆ ਉਹ ਦੁੱਧ ਬਣਾਉਣ ਦਾ ਥੋੜ੍ਹਾ ਤਰੀਕਾ ਇਸ ਤਰ੍ਹਾਂ ਵਾ ਕਿ ਅਸੀਂ ਦੁੱਧ ਨੂੰ ਉਬਾਲੀ ਵਾਸਤੇ ਧਰਦੇ ਹਾਂ ਉਹਦੇ ਵਿੱਚ ਮਸਾਲਾ ਦੁੱਧ ਵਾਲਾ ਮਸਾਲਾ ਵੀ ਪਾਉਂਦੇ ਹਾਂ ਜਾਂ ਕਈ ਲੋਕ ਇਕੱਲੀ ਇਲਾਚੀ ਹੀ ਪਾ ਲੈਂਦੇ ਆ ਵਿੱਚ ਥੋੜ੍ਹੀ ਖੰਡ ਵੀ ਪਾ ਕੇ ਉਹਨੂੰ ਉਬਾਲਾ ਆਉਣ 'ਤੇ ਦੁੱਧ ਜਿਹੜਾ ਤਿਆਰ ਹੋ ਜਾਂਦਾ ਹੈ ਫਿਰ ਜਿੱਦਾਂ ਹੁਣ ਗਰਮੀ ਵਿੱਚ ਅਸੀਂ ਨਿੰਬੂ ਪਾਣੀ ਵੀ ਪੀਂਦੇ ਹਾਂ ਨਿੰਬੂ ਪਾਣੀ ਵਿੱਚ ਥੋੜ੍ਹਾ ਪਾਣੀ ਲੈ ਕੇ ਉਹਨੂੰ ਖੰਡ ਖੋਰਦੇ ਹਾਂ ਵਿੱਚ ਥੋੜ੍ਹਾ ਨਮਕ ਪਾਉਂਦੇ ਹਾਂ ਉਹਨੂੰ ਖੋਰਕੇ ਫਿਰ ਅਸੀਂ ਕਾਲੀ ਮਿਰਚ ਪਾ ਲਈਏ ਕਾਲਾ ਲੂਣ ਪਾ ਲਈਏ ਫਿਰ ਨਿੰਬੂ ਨਚੋੜਦੇ ਹਾਂ ਨਿੰਬੂ ਨਚੋੜ ਕੇ ਇਸ ਨੂੰ ਇਹ 'ਚ ਬਰਫ ਵੀ ਪਾਉਂਦੇ ਹਾਂ ਇਹਨੂੰ ਠੰਢੇ ਪਾਣੀ ਵਿੱਚ ਪਾ ਕੇ ਫਿਰ ਉਹ ਵੀ ਨਿੰਬੂ ਪਾਣੀ ਵੀ ਅਸੀਂ ਇਸ ਤਰ੍ਹਾਂ ਬਣਾ ਕੇ ਪੀ ਸਕਦੇ ਹਾਂ ਜਿਸ ਤਰ੍ਹਾਂ ਹੁਣ ਗਰਮੀਆਂ ਵਿੱਚ ਰਾਤ ਸਮੇਂ ਕੱਚੀ ਲੱਸੀ ਵੀ ਪੀਂਦੇ ਆ ਰੋਟੀ ਦੇ ਬਾਅਦ ਕੱਚੀ ਲੱਸੀ ਬਣਾਉਣ ਦੇ ਪਾਣੀ ਪਾ ਕੇ ਵਿੱਚ ਦੁੱਧ ਪਾ ਕੇ ਉਹਦੇ 'ਚ ਥੋੜ੍ਹਾ ਨਮਕ ਪਾ ਕੇ ਉਹਨੂੰ ਕੱਚੀ ਲੱਸੀ ਨੂੰ ਤਿਆਰ ਕੀਤਾ ਜਾਂਦਾ ਹੈ ਠੰਢਾ ਪਾਣੀ ਵੀ ਪਾ ਸਕਦੇ ਹਾਂ ਠੰਢੀ ਹੋਣ ਵਾਸਤੇ ਬਰਫ ਵੀ ਪਾ ਸਕਦੇ ਹਾਂ ਇਸ ਤਰ੍ਹਾਂ ਕੱਚੀ ਲੱਸੀ ਵੀ ਅਸੀਂ ਘਰ ਵਿੱਚ ਪੀਂਦੇ ਹਾਂ